ਹਾਂਜੀ ਹਾਂਜੀ ਮੰਮੀ ਜੀ ਪੈਰੀਂ ਪੈਨਾ ਠੀਕ ਆ ਤੁਸੀਂ ਦੱਸੋ ਕੁਛ ਨਹੀਂ ਬਸ ਵਿਹਲਾ ਪੜ੍ਹਿਆ ਕਰਦਾ ਸੀ ਖਾ ਖਾਧਾ ਸੀ ਸਵੇਰੇ ਰੋਟੀ ਖਾਧੀ ਸੀ ਸ਼ਾਮੀ ਸ਼ਾਮੀ ਵੀ ਦੀਦੀ ਕੱਲ੍ਹ ਦੇ ਗਏ ਸੀ ਦੁੱਧ ਵਗੈਰਾ ਦੇ ਗਏ ਸੀ ਕਿਥੇ ਫ਼ਿਰਦਾ ਹੁੰਦਾ ਯਾਰ ਮੈਂ ਅਤੇ ਵਿਹਲਾ ਲੰਮਾ ਪੈ ਜਾਂਦਾ ਸਗੋਂ ਮੈਂ ਤਾਂ ਹਾਂਜੀ ਠੀਕ ਆ ਘੱਟ ਚਲਾਇਆ ਕਰਾਂਗਾ ਹਾਂਜੀ ਨਹੀਂ ਨਹੀਂ ਮੰਮੀ ਸਾਰੇ ਬੱਚੇ ਪੜ੍ਹਨ ਵਾਲੇ ਇੱਥੇ ਮੰਮੀ ਕਿੱਥੇ ਪੈਸੇ ਵੱਧ ਖਰਚ ਦਾ ਯਾਰ ਮੈਂ ਦਿੰਦੇ ਹੀ ਤੁਸੀਂ ਚਾਰ ਹਜ਼ਾਰ ਹੋ ਓਹੀ ਖਰਚਦਾ ਮੈਂ ਹਾਂਜੀ ਫਿਰ ਉਹ 'ਚ ਵੀ ਬਚਾ ਏ ਲੈਂਦਾ ਮੈਂ ਥੋੜ੍ਹੇ ਜਿਹੇ ਕੀ ਹੋ ਗਿਆ ਨਹੀਂ ਨਹੀਂ ਬਾਹਰ ਦੀ ਨਹੀਂ ਖਾਂਦਾ ਦੀਦੀ ਜਿਹੜੀ ਰੋਟੀ ਦਿੰਦੇ ਉਹੀ ਖਾਂਦਾ ਨਹੀਂ ਨਹੀਂ ਧੁੱਪ 'ਚ ਨਹੀਂ ਜਾਂਦਾ ਮੈਂ ਬਸ ਸਵੇਰੇ ਸਵੇਰੇ ਸੈਰ ਕਰਕੇ ਹਾਂਜੀ ਮੰਮੀ ਚਲੋ ਠੀਕ ਆ ਫਿਰ ਮੈਂ ਤਿਆਰ ਹੋ ਜਾਵਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਪੀ ਲੈਣਾ ਕੋਈ ਗੱਲ ਨਹੀਂ ਜਾਂਦੇ ਜਾਂਦੇ ਕਾਲਜ 'ਚ ਪੀ ਲਵਾਂਗਾ ਹਾਂਜੀ ਦੀਦੀ ਦੀਦੀ ਤਾਂ ਰੋਜ਼ ਦੀਦੀ ਫਿਰ ਰੋਟੀ ਦਿੰਦੇ ਮੈਨੂੰ ਡੈਡੀ ਨਾਲ ਵੀ ਕਰ ਲਈ ਵੱਡੀ ਦੀਦੀ ਦਾ ਵੀ ਕਿਹਾ ਸੀ ਸ਼ਾਮੀ ਫੋਨ ਕਰਾਂਗਾ ਚਲੋ ਓਕੇ